ਪੰਜਾਬੀ ਭਾਸ਼ਾ ਬਹੁਤ ਹੀ ਮਿੱਠੀ ਬੋਲੀ ਹੈ ਅਤੇ ਪੰਜਾਬ ਵਿੱਚ ਇਹ ਲੋਕ ਜਿਹੜੇ ਬੋਲਦੇ ਹਨ ਬਾਹਰਲੇ ਲੋਕ ਦੋ ਮਿੰਟ 'ਚ ਇਸ ਚੀਜ਼ ਦੀ ਪਹਿਚਾਣ ਕਰ ਲੈਂਦੇ ਹਨ ਕਿ ਇਹ ਬੰਦਾ ਪੰਜਾਬੀ ਜਿਸ ਤਰ੍ਹਾਂ ਦੀ ਬੋਲ ਰਿਹਾ ਹੈ ਇਹ ਪੰਜਾਬ ਨੂੰ ਬਿਲੋਂਗ ਕਰਦਾ ਹੋਏਗਾ ਜੇ ਕੋਈ ਬਾਹਰਲਾ ਦਿੱਲੀ ਜਾਂ ਬੌਂਬੇ ਵਾਲਾ ਬੰਦਾ ਪੰਜਾਬੀ ਬੋਲਦਾ ਹੈ ਤਾਂ ਉਹ ਫੱਟ ਪਹਿਚਾਣਿਆ ਜਾਂਦਾ ਹੈ ਕਿ ਇਹ ਪੰਜਾਬੀ ਬੋਲੀ ਨਹੀਂ ਹੈ ਔਰ ਪੰਜਾਬ ਦੀ ਬੋਲੀ ਬਹੁਤ ਮਿੱਠੀ ਬੋਲੀ ਮੰਨੀ ਜਾਂਦੀ ਹੈ ਜਿਹਦੇ ਕਰਕੇ ਲੋਕਾਂ ਦੇ ਜਿਹੜੇ ਕਿ ਬਾਹਰ ਗਏ ਨੇ ਪੰਜਾਬ ਤੋਂ ਵੀ ਔਰ ਇੰਡੀਆ ਤੋਂ ਵੀ ਔਰ ਪੰਜਾਬ ਦੇ ਲੋਕ ਬਾਹਰਲੇ ਕੰਟਰੀਆਂ ਵਿੱਚ ਵੀ ਜਾ ਕੇ ਆਪਣਾ ਰਸੂਖ ਪੈਦਾ ਕਰ ਰਹੇ ਹਨ